ਮੈਨੂੰ ਡਰਾਇੰਗ ਬਹੁਤ ਵਧੀਆ ਲੱਗਦੀ ਹੈ ਮੈਨੂੰ ਚਿੱਤਰਕਾਰੀ ਕਰਨ ਦਾ ਬਹੁਤ ਸ਼ੌਂਕ ਹੈ ਸਕੂਲ ਟਾਈਮ ਤੋਂ ਹੀ ਮੈਂ ਚਿੱਤਰਕਾਰੀ ਕਰਦਾ ਰਿਹਾ ਹਾਂ ਮੈਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ ਸੱਥ ਔਰ ਆਪਣੇ ਪਿੰਡ ਦੇ ਹਰੇਕ ਚੀਜ਼ ਦੀ ਇੱਕ ਤਸਵੀਰ ਬਣਾਉਣਾ ਚਾਹੁੰਦਾ ਹਾਂ ਜਿਸ ਵਿੱਚ ਮੇਰੇ ਗੁਰਦੁਆਰਾ ਸਾਹਿਬ ਥਾਨ ਇਹ ਟੈਂਕੀ ਹਰੇਕ ਚੀਜ਼ ਦਰਖ਼ਤ ਘਰ ਸਾਰੇ ਹੀ ਆ ਜਾਣ ਔਰ ਮੈਂ ਇਹਨਾਂ ਨੂੰ ਇੱਕ ਚਿੱਤਰ ਵਿੱਚ ਤਿਆਰ ਕਰਾਂ ਮੈਨੂੰ ਇਸ ਚੀਜ਼ ਦਾ ਕਾਫ਼ੀ ਸ਼ੌਂਕ ਹੈ ਔਰ ਮੈਨੂੰ ਕਰਨਾ ਇਹ ਬਹੁਤ ਵਧੀਆ ਲੱਗਦਾ ਹੈ